ਪੰਜਾਬ ਖੇਤਰ ਦਾ ਇਤਿਹਾਸ ਸਦੀਆਂ ਤੋਂ ਹੀ ਵੱਖ ਵੱਖ ਸਾਮਰਾਜਾਂ ਅਤੇ ਰਾਜਵੰਸ਼ਾਂ ਦੁਆਰਾ ਬਹੁਤ ਪ੍ਰਭਾਵਿਤ ਹੋਇਆ ਹੈ ਇਹ ਖੇਤਰ ਇਤਿਹਾਸਿਕ ਅਤੇ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਹਮੇਸ਼ਾ ਮਹੱਤਵਪੂਰਨ ਰਿਹਾ ਹੈ ਜਿਸ ਕਰਕੇ ਇਹਨੇ ਕਈ ਵਾਰ ਵੱਖ ਵੱਖ ਸੰਤਾਵਾਂ ਦਾ ਰਾਜ ਪਾਇਆ ਹੈ ਆਓ ਕੁਝ ਸਾਮਰਾਜਾਂ ਅਤੇ ਰਾਜਵੰਸ਼ਾਂ 'ਤੇ ਨਜ਼ਰ ਮਾਰਦੇ ਹਾਂ ਜਿਹਨਾਂ ਨੇ ਪੰਜਾਬ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਸਭ ਤੋਂ ਪਹਿਲਾਂ ਡਰਾਵਿੰਡੀਨ ਬੁਲਾਰੇ ਪੰਜਾਬ ਦੇ ਖੇਤਰਾਂ ਅਤੇ ਪ੍ਰਾਚੀਨ ਬਾਸਾਂ ਵਿੱਚੋਂ ਇੱਕ ਸਨ ਉਹਨਾਂ ਦਾ ਸਮਾਜ ਅਤੇ ਸੱਭਿਆਚਾਰ ਪੰਜਾਬ ਦੀਆਂ ਪ੍ਰਾਚੀਨ ਵਿਰਾਸਤਾਂ ਵਿੱਚ ਦਰਸਾਇਆ ਜਾਂਦਾ ਹੈ ਉਹਨਾਂ ਨੇ ਸੱਭਿਆਚਾਰ ਅਤੇ ਖੇਤੀਬਾੜੀ ਭਾਸ਼ਾ ਅਤੇ ਕਲਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ

ਕਿਉਂਕਿ ਇਸ ਦੌਰਾਨ ਕਲਾ ਸਿਹਤ ਅਤੇ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀ ਉੱਨਤੀ ਹੋਈ ਸੀ ਚੌਥਾ ਪੰਜਵੀਂ ਅਤੇ ਛੇਵੀਂ ਸਦੀ ਵਿੱਚ ਹੋਣਾਂ ਦੇ ਹਮਲਿਆਂ ਨੇ ਪੰਜਾਬ ਖੇਤਰ ਵਿੱਚ ਬਹੁਤ ਕੁਝ ਤਬਾਹ ਕੀਤਾ ਇਹਨਾਂ ਹਮਲਿਆਂ ਦੇ ਕਾਰਨ ਖੇਤਰ ਦੀ ਰਾਜਨੀਤਿਕ ਅਤੇ ਸਥਿਤੀ ਸੱਭਿਆਚਾਰਕ ਢਾਂਚੇ ਵਿੱਚ ਬਦਲਾਵ ਆਇਆ ਸੀ ਫਿਰ ਤੋਂ ਗਜ਼ਨੀ ਅਤੇ ਗੌਰੀ ਸਲਤਨਤ ਦਾ ਰਾਜ ਆਇਆ ਜਿਸਦੇ ਵਿੱਚ ਮਹਿਮੂਦ ਗਜ਼ਨਵੀ ਅਤੇ ਮਹਿਮੂਦ ਗੌਰੀ ਨੇ ਪੰਜਾਬ ਖੇਤਰ ਵਿੱਚ ਕਈ ਹਮਲੇ ਕੀਤੇ ਅਤੇ ਇਸ ਖੇਤਰ ਨੂੰ ਸ਼ਾਸਨ ਤਹਿਤ ਲਿਆਂਦਾ ਇਹਨਾਂ ਹਮਲਿਆਂ 'ਤੇ ਇਤਿਹਾਸਿਕ ਦੌਰ 'ਤੇ ਇਸ ਖੇਤਰ 'ਤੇ ਇੱਕ ਆਨੰਦ ਦਾ ਪ੍ਰਭਾਵ ਪਿਆ ਫਿਰ ਦਿੱਲੀ ਸਲਤਨਤ 'ਤੇ ਮੁਗਲ ਸਾਮਰਾਜ ਆਇਆ ਜਿਸ ਵਿੱਚ ਦਿੱਲੀ ਸਲਤਨਤ ਅਤੇ ਫਿਰ ਮੁਗਲ ਸਾਮਰਾਜ ਨੇ ਪੰਜਾਬੀ ਖੇਤਰ ਦੇ ਵਿੱਚ ਸ਼ਾਸਨ ਕੀਤਾ ਇਸ ਦੇ ਦੌਰਾਨ ਉਹਨਾਂ ਨੇ ਸਾਮਰਾਜ ਦਾ ਫੈਲਾਅ ਕੀਤਾ ਪੰਜਾਬ ਵਿੱਚ ਕਲਾ ਐਰਕੀਟੈਕਟ ਅਤੇ ਸੱਭਿਆਚਾਰ ਵਿੱਚ ਬੜੀ ਉੱਨਤੀ ਹੋਈ ਲਾਹੌਰ ਮੁਗਲ ਸਾਮਰਾਜ ਦਾ ਮਹੱਤਵਪੂਰਨ ਸ਼ਹਿਰ ਬਣਿਆ ਫਿਰ ਆਇਆ ਸਿੱਖ ਰਾਜ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਲੀ ਵਰ੍ਹਿਆਂ ਦਾ ਰਿਹਾ ਜਿਸ ਦੇ ਵਿੱਚ ਸਿੱਖ ਸਾਮਰਾਜ ਨੇ ਇੱਕ ਉੱਨਤ ਪੰਜਾਬ ਦੇ ਵਿੱਚ ਇੱਕ ਬਹੁਤ ਅੱਛਾ ਮਾਹੌਲ ਬਣਾਇਆ ਜਿਹਦੇ ਵਿੱਚ ਹਰ ਇੱਕ ਧਰਮਾਂ ਨੂੰ ਇੱਕ ਪਹਿਲ ਦੇ ਆਧਾਰ ਦੇ ਉੱਤੇ ਦੇਖਿਆ ਜਾਂਦਾ ਸੀ ਜਿਸਦੇ ਵਿੱਚ ਨੌਂ ਪਰਸੈਂਟ ਸਿੱਖ ਅਤੇ ਬਾਕੀ ਹਿੱਸਾ ਦੂਸਰੇ ਧਰਮਾਂ ਨੂੰ ਪਹਿਲ ਦੇ ਅਧਾਰ ਦੇ ਉੱਤੇ ਨੌਕਰੀਆਂ ਜ਼ਮੀਨਾਂ ਅਤੇ ਕਾਰੋਬਾਰ ਦੇ ਵਿੱਚ ਹਿੱਸਾ ਪਾਉਂਦੇ ਸਨ

ਇਸ ਸਾਮਰਾਜ ਦੇ ਅਤੇ ਵ ਰਾਜਵੰਸ਼ਾਂ ਨੇ ਪੰਜਾਬ ਦੀ ਸੱਭਿਆਚਾਰਕ ਸਮਾਜਿਕ ਅਤੇ ਰਾਜਨੀਤਿਕ ਸਥਿਤੀ ਨੂੰ ਬਹੁਤ ਪ੍ਰਭਾਵ ਪਾਇਆ ਜਿਸ ਦੇ ਨਤੀਜੇ ਵਜੋਂ ਪੰਜਾਬ ਇੱਕ ਵਿਲੱਖਣ ਸੱਭਿਆਚਾਰਕ ਮਿਸ਼ਨ ਦੇ ਵਿੱਚ ਵਿਰਾਸਤ ਦੇ ਵਿੱਚ ਖੇਤਰ ਫੈਲ ਗਿਆ ਧੰਨਵਾਦ